ਹੈਲੋ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਸਿੱਧੂ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਮੈਂ ਰਮਨਦੀਪ ਬੋਲ ਰਹੀ ਹਾਂ ਪਥਰਾੜਾ ਤੋਂ ਵੀਰੇ ਅਸੀਂ ਸੱਤ ਕੁ ਵਜੇ ਪਾਰਟੀ ਕਰਨੀ ਹੈ ਤੁਹਾਡੇ ਰੈਸਟੋਰੈਂਟ ਦੇ ਵਿੱਚ ਮੇਰੀ ਫਰੈਂਡ ਦਾ ਜਨਮ ਦਿਨ ਹੈ ਵੀਰੇ ਵੀਰੇ ਅਸੀਂ ਦੋ ਕੇਕ ਵੀ ਆਡਰ ਕਰਨੇ ਆ ਤੁਹਾਡੇ ਕੋਲੋਂ ਮਿਲ ਜਾਣਗੇ ਸੱਤ ਪੀਜ਼ੇ ਆਰਡਰ ਕਰਨੇ ਆ ਵੀਰੇ ਕਿਉਂਕਿ ਮੇਰੇ ਬਾਕੀ ਫਰੈਂਡ ਵੀ ਹੋਣਗੇ ਜੋ ਵੀ ਖਾਣਾ ਸਰ ਹੈ ਉਸ ਵਿੱਚ ਮਸਾਲਾ ਥੋੜ੍ਹਾ ਘੱਟ ਹੋਣਾ ਚਾਹੀਦਾ ਹੈ ਸਰ ਜੋ ਵੀ ਤੁਹਾਡੇ ਜਿਹੜੇ ਟੇਬਲ ਨੇ ਉਹ ਵੀ ਸਾਫ਼ ਸੁਥਰੇ ਹੋਣੇ ਚਾਹੀਦੇ ਆ ਅਸੀਂ ਦੋ ਘੰਟੇ ਪਾਲਟੀ ਕਰਨੀ ਆ ਅਤੇ ਜਿਹੜਾ ਖਾਣਾ ਆਰਡਰ ਕਰਾਂਗੇ ਉਹਦੇ 'ਤੇ ਸਾਨੂੰ ਡਿਸਕਾਊਂਟ ਵੀ ਚਾਹੀਦਾ ਸਰ ਡਿਸਕਾਉਂਟ ਦੇ ਸਕਦੇ ਹੋ ਸਰ ਸਾਨੂੰ ਤੁਹਾ ਤੁਸੀਂ ਸਾਨੂੰ ਅਸੀਂ ਤੁਹਾਡੇ ਰੈਸਟੋਰੈਂਟ ਦੇ ਵਿੱਚ ਥੋੜ੍ਹੇ ਦਿਨਾਂ ਤੋਂ ਹੀ ਆਉਂਦੇ ਰਹਿੰਦੇ ਹੈਗੇ ਤੁਹਾਡੇ ਕੋਲੋਂ ਹੀ ਖਾਣਾ ਖਾਣ ਆਉਂਦੇ ਹੈਗੇ ਇਸ ਲਈ ਸਰ ਸਾਨੂੰ ਖਾਣੇ ਦੇ ਰੇਟ ਵੀ ਬਹੁਤ ਜ਼ਿਆਦਾ ਘੱਟ ਚਾਹੀਦੇ ਆ ਥੈਂਕ ਯੂ ਸਰ